ਗਤਕਾ ਖੇਡਣ ਵਾਸਤੇ ਸਰੀਰ ਦੀ ਤੰਦਰੁਸਤੀ ਵਾਸਤੇ ਸਰੀਰ ਦੀ ਚੜ੍ਹਦੀ ਕਲਾ ਵਾਸਤੇ ਜੋ ਪੌਸ਼ਟਿਕ ਭੋਜਨ ਹੈ ਸੋ ਪਦਾਰਥ ਜਿਵੇਂ ਦੁੱਧ ਦਹੀਂ ਲੱਸੀ ਮੱਖਣ ਘਿਉ ਦੇਸੀ ਘਿਓ ਅਤੇ ਹੋਰ ਜੋ ਫਲ ਫਰੂਟ ਹਨ ਸੋ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰਕੇ ਭਾਵ ਸਹੀ ਤਰੀਕੇ ਦੇ ਨਾਲ ਇਹ ਭੋਜਨ ਪਦਾਰਥ ਵਰਤ ਕੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਸਰੀਰ ਦੀ ਚੜ੍ਹਦੀ ਕਲਾ ਵਾਸਤੇ ਜੋ ਇਹ ਭੋਜਨ ਹੈ ਇਸ ਨੂੰ ਵਰਤਿਆ ਜਾਂਦਾ ਹੈ ਕਈ ਲੋਕ ਜੋ ਹਨ ਉਹ ਮਾਸ ਵੀ ਇਸ ਦੇ ਵਿੱਚ ਸ਼ਾਮਿਲ ਕਰ ਲੈਂਦੇ ਹਨ ਸੋ ਇਸ ਦੇ ਜੀਵਨ ਇਸ ਜੀਵ ਜੀਵਨ ਦੇ ਵਿੱਚ ਇਹਨਾਂ ਪਦਾਰਥਾਂ ਨੂੰ ਵਰਤ ਕੇ ਇਸ ਖੁਰਾਕ ਨੂੰ ਅਤੇ ਇਸ ਸਰੀਰ ਨੂੰ ਐਨਰਜੀ ਵੀ ਚਾਹੀਦੀ ਹੈ ਅਤੇ ਫੁਰਤੀ ਵੀ ਚਾਹੀਦੀ ਹੈ ਸੋ ਬਾਲ ਵੀ ਵਿੱਚ ਚਾਹੀਦਾ ਅਤੇ ਸਰੀਰ ਦੇ ਵਿੱਚ ਫੁਰਤੀ ਵੀ ਚਾਹੀਦੀ ਹੈ ਸੋ ਇਸ ਕਰਕੇ ਇਸ ਭੋਜਨ ਨੂੰ ਵਰਤ ਕੇ ਸੋ ਐਨੂ ਚੜ੍ਹਦੀ ਕਲਾ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਕੇ ਚੜ੍ਹਦੀ ਕਲਾ ਦੇ ਵਿੱਚ ਗੱਤਕਾ ਗੱਤਕੇ ਦੇ ਵਿੱਚ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਲਾ ਕੇ ਫਿਰ ਯੋਧੇ ਫਤਹਿ ਪ੍ਰਾਪਤ ਕਰਦੇ ਸਨ